ਮੈਂ ਐਮਾਜ਼ੋਨ ਤੋਂ ਇੱਕ ਕੈਮਰਾ ਔਡਰ ਕੀਤਾ ਸੀ ਜਿਹੜਾ ਕਿ ਮੈਨੂੰ ਮਾਰਕੀਟ ਨਾਲੋਂ ਬਹੁਤ ਹੀ ਘੱਟ ਪ੍ਰਾਈਸ 'ਤੇ ਮਿਲ ਰਿਹਾ ਸੀ ਕੈਮਰੇ ਦਾ ਬ੍ਰੈਂਡ ਹੈ ਸੋਨੀ ਜ਼ੀਰੋ ਜ਼ੀਰੋ ਵੰਨ ਅਤੇ ਇਸ ਨੂੰ ਮੈਂ ਇਸ ਲਈ ਬਾਏ ਕੀਤਾ ਕਿ ਮੈਂ ਬਹੁਤ ਹੀ ਆਪਣੇ ਲਾਗੇ ਸ਼ਾਗੇ ਦੀਆਂ ਦੁਕਾਨਾਂ ਤੋਂ ਜਾ ਕੇ ਦੇਖਿਆ ਇਹਦਾ ਪ੍ਰਾਈਜ਼ ਪਤਾ ਕੀਤਾ ਕਿਸੇ ਦੁਕਾਨ 'ਤੇ ਸੱਤਰ ਹਜ਼ਾਰ ਕਹਿੰਦੇ ਸੀ ਕਿਤੇ ਕਿਸੇ ਦੁਕਾਨ 'ਤੇ ਅੱਸੀ ਹਜ਼ਾਰ ਕਹਿੰਦੇ ਸੀ ਤੋਂ ਇਹ ਕੈਮਰਾ ਮੇਰੇ ਬਜਟ ਤੋਂ ਬਾਹਰ ਜਾ ਰਿਹਾ ਸੀ ਸੋ ਫਿਰ ਮੈਂ ਐਮਾਜ਼ੋਨ ਤੋਂ ਐਮਾਜ਼ੋਨ 'ਤੇ ਆਇਆ ਐਮਾਜ਼ੋਨ 'ਤੇ ਮੈਨੂੰ ਕਾਫ਼ੀ ਸਸਤਾ ਪੈ ਰਿਹਾ ਸੀ ਮਾਰਕੀਟ ਪ੍ਰਾਈਜ਼ ਨਾਲੋਂ ਮਿਨੀਮਮ ਮੈਨੂੰ ਸੱਠ ਹਜ਼ਾਰ ਤੱਕ ਮਿਲਦਾ ਪਿਆ ਸੀ ਮੈਂ ਐਮਾਜ਼ੋਨ 'ਤੇ ਆਇਆ ਐਮਾਜ਼ੋਨ 'ਤੇ ਪਚਵੰਜਾ ਹਜ਼ਾਰ ਤੱਕ ਰੇਟ ਹੈਗਾ ਸੀ ਇਹਦਾ ਅਤੇ ਉਸ ਤੋਂ ਬਾਅਦ ਕੁਪਨ ਕਾਪਨ ਲਗਾ ਕੇ ਮੈਨੂੰ ਇਹ ਪੈ ਗਿਆ ਪੰਜਾਹ ਕ ਹਜ਼ਾਰ ਦੇ ਲਾਗੇ ਸ਼ਾਗੇ ਪੈ ਗਿਆ ਇਹ ਸਾਨੂੰ ਅਤੇ ਮੈਨੂੰ ਵਧੀਆ ਲੱਗੀ ਡੀਲ ਅਤੇ ਮੈਂ ਕੈਮਰਾ ਔਨਲਾਈਨ ਔਡਰ ਕਰ ਦਿੱਤਾ ਅਤੇ ਔਡਰ ਕਰਨ ਤੋਂ ਬਾਅਦ ਦੋ ਤਿੰਨ ਦਿਨਾਂ 'ਚ ਡਿਲੀਵਰੀ ਇਹਦੀ ਆ ਗਈ ਅਤੇ ਉਸ ਤੋਂ ਬਾਅਦ ਮੈਂ ਕੈਮਰਾ ਓਪਨ ਕਰਕੇ ਦੇਖਿਆ ਤਾਂ ਕੋਈ ਸਕ੍ਰੈਚ ਨਹੀਂ ਸੀ ਐਮਾਜ਼ੋਨ ਦੀ ਬਹੁਤ ਵਧੀਆ ਡਿਲੀਵਰੀ ਹੀ ਇਹਨਾਂ ਨੇ ਕੀਤੀ ਜਿਹੜਾ ਡਿਲੀਵਰੀ ਬੋਆਏ ਉਹ ਵੀ ਰਿਸਪੈਕਟਿਵ ਗੱਲ ਕਰਦਾ ਪਿਆ ਸੀ ਅਤੇ ਕੈਮਰਾ ਮੈਂ ਚੈੱਕ ਕਰਨ ਦੀ ਗੱਲ ਕਰਾਂ ਤਾਂ ਮੈਂ ਚੈੱਕ ਜਦੋਂ ਕੀਤਾ ਕੈਮਰਾ ਇਹਦਾ ਪੋਟਰੇਟ ਮੋਡ ਬਹੁਤ ਵਧੀਆ ਸੀ ਜ਼ੂਮ ਫਲੈਸ਼ ਸਪੀਡ ਕਲਿੱਕ ਕਰਨ ਦੀ ਬਹੁਤ ਹੀ ਤੇਜ਼ ਸੀ ਮਤਲਬ ਪੂਰਾ ਸਮੂਥ ਚੱਲ ਚੱਲ ਰਿਹਾ ਸੀ ਕੈਮਰਾ ਜਦੋਂ ਮੈਂ ਫੋ ਇਕੱਲੀ ਇਕੱਲੀ ਫੋਟੋ ਦੇਖੀ ਮਤਲਬ ਜ਼ੂਮ ਕਰਕੇ ਇਹਨੂੰ ਫੋਟੋ ਨੂੰ ਬਹੁਤ ਹੀ ਵਧੀਆ ਫੋਟੋ ਕਲਿੱਕ ਕਰਦਾ ਪਿਆ ਸੀ ਇਹ ਹਾਂਜੀ ਅਤੇ ਕੁੱਲ ਮਿਲਾ ਕੇ ਮੈਨੂੰ ਇਹ ਕੈਮਰਾ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਅਤੇ ਮੈਂ ਆਪਣੇ ਦੋਸਤਾਂ ਨੂੰ ਵੀ ਸੁਜੈਸਟ ਕਰਾਂਗਾ ਕਿ ਤੁਸੀਂ ਇਹ ਕੈਮਰਾ ਲਵੋ ਕ ਲਵੋ